ਵੱਖ ਵੱਖ ਕਿਸਮ ਦੇ ਜਾਨਵਰ ਸਾਡੇ ਲਈ ਬਹੁਤ ਮਹੱਤਵ ਰੱਖਦੇ ਨ ਹਨ ਜਾਨਵਰ ਜੋ ਹਨ ਉਹ ਦੋ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਕਿ ਇੱਕ ਤਰ੍ਹਾਂ ਦੇ ਪਾਲਤੂ ਜੋ ਕਿ ਅਸੀਂ ਘਰਾਂ 'ਚ ਪਾਲਦੇ ਹਾਂ ਦੂਜੇ ਜੋ ਕਿ ਜੰਗਲਾਂ ਵਿੱਚ ਰਹਿੰਦੇ ਹਨ ਜੋ ਪਾਲਤੂ ਜਾਨਵਰ ਹਨ ਉਹਨਾਂ ਨੂੰ ਅਸੀਂ ਘਰਾਂ ਵਿੱਚ ਰੱਖਦੇ ਹਾਂ ਤਾਂ ਉਹਨਾਂ ਦੀ ਦੇਖ ਭਾਲ ਸਾਨੂੰ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ ਜਿਵੇਂ ਕਿ ਸਾਨੂੰ ਸਮੇਂ ਸਮੇਂ 'ਤੇ ਉਹਨਾਂ ਦੇ ਉਹਨਾਂ ਨੂੰ ਦਾਣਾ ਪਾਣੀ ਜਾਂ ਪੱਠੇ ਦੇਣੇ ਚਾਹੀਦੇ ਹਨ ਹੋ ਸਕੇ ਤਾਂ ਸਾਨੂੰ ਉਹਨਾਂ ਦੇ ਡਾਕਟਰੀ ਦੇਖ ਭਾਲ ਵੀ ਕਰਨੀ ਚਾਹੀਦੀ ਹੈ ਪਸ਼ੂ ਜੋ ਹਨ ਸਾਡੇ ਲਈ ਬਹੁਤ ਉਪਯੋਗੀ ਹੁੰਦੇ ਹਨ ਜਿਵੇਂ ਕਿ ਗਾਂ ਸਾਨੂੰ ਦੁੱਧ ਦਿੰਦੀ ਹੈ ਇਹ ਸਾਡੇ ਆਮਦਨ ਦਾ ਵੀ ਮਹੱਤਵਪੂਰਨ ਉਪਯੋਗੀ ਹੁੰਦਾ ਹੈ ਕਿਉਂਕਿ ਜਿਵੇਂ ਕਿ ਦੁੱਧ ਤੋਂ ਦੁੱਧ ਵੇਚ ਕੇ ਅਸੀਂ ਆਪਣੇ ਘਰ ਬਾਰ ਚਲਾ ਸਕਦੇ ਹਾਂ ਇਸ ਤਰ੍ਹਾਂ ਜੋ ਮੁਰਗੀ ਰ ਰੱਖਦੇ ਹਨ ਉਹਨਾਂ ਨੂੰ ਮੁਰਗੀ ਪਾਲਣ ਪਾਲਣ ਤੋਂ ਵੀ ਬਹੁਤ ਕੁਛ ਫ਼ਾਇਦਾ ਹੁੰਦਾ ਹੈ ਇਸ ਤਰ੍ਹਾਂ ਜੋ ਪਾਲਤੂ ਘਰਾਂ ਵਿੱਚ ਪਾਲਣ ਵਾਲੇ ਜਾਨਵਰ ਹਨ ਉਹ ਸਾਡੇ ਲਈ ਬਹੁਤ ਮਹੱਤਵ ਰੱਖਦੇ ਹਨ ਇਸ ਤਰ੍ਹਾਂ ਸਾਨੂੰ ਇਹਨਾਂ ਜਾਨਵਰਾਂ ਨੂੰ ਇੱਕ ਬਚ ਚੰਗੇ ਥਾਂ 'ਤੇ ਰੱਖਣਾ ਚਾਹੀਦਾ ਹੈ ਤਾਂ ਕਿ ਹਵਾਦਾਰ ਸਥਾਨ ਹੋਣਾ ਚਾਹੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਕਿ ਉਹ ਬਹੁਤ ਆਰਾਮ ਨਾਲ ਰਹਿ ਸਕਣ ਅਤੇ ਉਹਨਾਂ ਦੀ ਦੇਖ ਭਾਲ ਚੰਗੀ ਤਰ੍ਹਾਂ ਹੋ ਸਕੇ ਬਹੁਤ ਜ਼ਿਆਦਾ ਮਾਤਰਾ ਵਿੱਚ ਜਿਵੇਂ ਕਿ ਅਗਰ ਪਸ਼ੂ ਅਸੀਂ ਰੱਖਦੇ ਹਾਂ ਤਾਂ ਉਹਨਾਂ ਦੀ ਦੇਖ ਭਾਲ ਚੰਗੀ ਤਰ੍ਹਾਂ ਨਹੀਂ ਹੋ ਸਕਦੀ ਇਸ ਲਈ ਸਾਨੂੰ ਉਹਨਾਂ ਦੀ ਦੇਖ ਭਾਲ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ